ਬੱਚੇ ਖੇਤੀ ਪਸ਼ੂ ਪਾਲਣ ਛੋਟੇ ਕਾਰੋਬਾਰ ਇਹ ਸਾਰੇ ਸਕੂਲਾਂ ਵਿੱਚ ਸਿਖਾਉਂਦੇ ਹਨ ਅਹ ਅਤੇ ਸਾਡੇ ਮਤਲਬ ਕਿ ਪਿੰਡਾਂ ਵਿੱਚ ਮੇਲਿਆਂ ਵਿੱਚ ਹੋਰ ਵੀ ਟੀਮ ਆਉਂਦੀ ਹੈ ਉਹ ਉਹਨਾਂ ਬਾਰੇ ਨੌਲੇਜ ਦਿੰਦੀ ਹੈ ਉਹਦੇ ਸੈਮੀਨਾਰ ਲੱਗਦੇ ਹਨ ਉਹ ਛੇ ਪੰਜ ਛੇ ਦਿਨ ਉਹ ਉਹਨਾਂ ਦੀਆਂ ਕਲਾਸਿਸ ਲਾਉਂਦੇ ਹਨ ਟ੍ਰੇਨਿੰਗ ਦਿੰਦੇ ਹਾਂ ਸਿਖਾਉਂਦੇ ਹਾਂ ਕਿ ਕੇ ਛੋਟੀ ਤੋਂ ਛੋਟੇ ਵੱਡਾ ਤੋਂ ਵੱਡਾ ਕਾਰੋਬਾਰ ਬਾਰੇ ਉਹਨਾਂ ਨੂੰ ਨੌ ਨੌਲੇਜ ਦਿੰਦੇ ਹਾਂ ਕਿ ਤਾਂ ਕਿ ਉਹ ਅੱਗੇ ਜੇ ਉਹ ਅੱਗੇ ਨਹੀਂ ਪੜ੍ਹ ਸਕਦੇ ਤਾਂ ਉਹ ਪਸ਼ੂ ਪਾਲਣ ਖੇਤੀਬਾੜੀ ਹੋਰ ਕਈ ਕਾਰੋਬਾਰ ਆਪਣੇ ਖੋਲ੍ਹ ਸਕਦੇ ਹਾਂ ਜਾਂ ਫਿਰ ਡਾਇਰੀ ਵਿੱਚ ਕੰਮ ਕਰ ਸਕਦੇ ਹਾਂ ਤਾਂ ਕਿ ਉਹ ਆਪਣਾ ਅੱਗੇ ਕੰਮ ਕਰ ਸਕਣ ਆਪਣਾ ਖਰਚਾ ਆਪ ਚੱਕ ਸਕਣ ਅਤੇ ਖੇਤਾਂ ਵਿੱਚ ਕੰਮ ਖਰ ਕਰ ਸਕਣ ਹੋਰ ਵੀ ਉਨ੍ਹਾਂ ਦੇ ਕੰਮ ਅੱਗੇ ਲੋੜ ਪੈਂਦੀ ਹੈ ਤਾਂ ਕਰਕੇ ਉਹਨਾਂ ਨੂੰ ਇਹਨਾਂ ਦੀ ਸਿੱਖਿਆ ਲਈ ਸਕੂਲਾਂ ਆਈ ਟੀ ਆਈ ਹੋਰ ਵੀ ਸਿੱਖਿਅਤ ਖੁੱਲ੍ਹੇ ਹੋਏ ਹਨ